ਵੈਸੇ ਗੇਮਾਂ ਤਾਂ ਕਾਫੀ ਖੇਡੀਆਂ ਜਾਂਦੀਆਂ ਹਨ ਪਰ ਪਿਛਲੇ ਕੁਝ ਸਮੇਂ ਤੋਂ ਸਾਡੇ ਬੱਚੇ ਜਿਹੜੇ ਆ ਉਹ ਥੋੜ੍ਹੇ ਬਦਲ ਜਿਹੇ ਗਏ ਆ ਉਹ ਜਿਹੜੀਆਂ ਵਾਂ ਉਹ ਕਮਰੇ ਦੇ ਅੰਦਰ ਜਾਨੀ ਕਿ ਇਨਡੋਰ ਗੇਮਾਂ ਖੇਡਣੀਆਂ ਹੀ ਪਸੰਦ ਕਰਦੇ ਆ ਜਿਵੇਂ ਕਿ ਟੇਬਲ ਟੈਨਸ ਹੋ ਗਈ ਬੈਡਮਿੰਟਨ ਹੋ ਗਈ ਇਸ ਤੋਂ ਇਲਾਵਾ ਕੈਰਮ ਬੋਰਡ ਪਰਿਵਾਰ ਦੇ ਵਿੱਚ ਬੈਠ ਕੇ ਬੜੇ ਕਈ ਬੱਚੇ ਉਤਸ਼ਾਹ ਦੇ ਨਾਲ ਖੇਡਦੇ ਆ ਕੁਝ ਲੋਕ ਟੈਕਨੋਲਜੀ ਦਾ ਜ਼ਮਾਨਾ ਹੋ ਕੇ ਵੈਸੇ ਤਾਂ ਮੋਬਾਇਲ ਦੇ ਗੁਲਾਮ ਹੋ ਕੇ ਰਹਿ ਗਏ ਆ ਬੱਚੇ ਮੋਬਾਇਲ ਦੇ ਵਿੱਚ ਹੀ ਜ਼ਿਆਦਾਤਰ ਗੇਮਾਂ ਖੇਡਦੇ ਆ ਪਰ ਫਿਰ ਵੀ ਕਾਫੀ ਬੱਚਿਆਂ ਦੇ ਵਿੱਚ ਉਤਸ਼ਾਹ ਹੈ ਜਿਵੇਂ ਕਿ ਸਕੇਟਿੰਗ ਗੇਮ ਖੇਡੀ ਜਾਂਦੀ ਹੈ ਸ਼ਤਰੰਜ ਹੈ ਸ਼ਤਰੰਜ ਪਹਿਲਾਂ ਤਾਂ ਵੱਡੇ ਲੋਕਾਂ ਦੀ ਖੇਡ ਸੀ ਪਰ ਕੁਝ ਸਮੇਂ ਤੋਂ ਇਹ ਸ਼ਤਰੰਜ ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਦੇ ਨਾਲ ਖੇਡੀ ਜਾਂਦੀ ਹੈ ਜ਼ਿਆਦਾਤਰ ਇਹ ਔਨਲਾਈਨ ਵਗੈਰਾ ਖੇਡੀ ਜਾਂਦੀ ਏ ਮੋਬਾਇਲ ਦੇ ਉੱਪਰ ਅਤੇ ਹੋਰ ਵੀ ਕਾਫੀ ਆ ਜਿਸ ਤਰ੍ਹਾਂ ਹਾਈਡ ਐਂਡ ਸੀਕ ਲੁਕਣ ਮੀਟੀ ਜਿਹਨੂੰ ਪੰਜਾਬ ਦੇ ਵਿੱਚ ਕਹਿ ਦਿੰਦੇ ਆ ਉਹ ਵੀ ਬੱਚੇ ਸਕੂਲਾਂ ਦੇ ਵਿੱਚ ਜਾਂ ਟਿਊਸ਼ਨ 'ਤੇ ਜਾ ਕੇ ਇਸ ਤਰ੍ਹਾਂ ਖੇਡ ਕੇ ਆਪਣਾ ਟਾਈਮ ਜਿਹੜਾ ਉਹ ਪਾਸ ਕਰਦੇ ਆ